ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਹੋਰ ਕਿਵੇਂ ਹੋ ਜੀ ਮੈਂ ਹਾਂ ਹੋਰ ਕਿਆ ਹਾਲ ਚਾਲ ਹੈ ਜੀ ਤੁਹਾਡਾ ਅੱਛਾ ਅੰਕਲ ਜੀ ਮੈਂ ਪੰਜਾਬ ਬੋਰਡ ਦਫਤਰ ਜਾ ਕੇ ਆਉਣਾ ਸੀਗਾ ਜੀ ਉਹਦਾ ਰਸਤਾ ਦੱਸ ਸਕਦੇ ਆ ਜੀ ਮੈਂ ਜੀ ਆਪਣਾ ਖਿਦਰਾਬਾਦ ਖੜ੍ਹਾਂ ਜੀ

ਠੀਕ ਹੈ ਜੀ ਅੱਛਾ ਜੀ ਚੰਡੀਗੜ੍ਹ ਨਹੀਂ ਜਾਣਾ ਧਨਾਸ ਨੂੰ ਚਲੇ ਜਾਣਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਜਿਹੜਾ ਸਿੰਘ ਸ਼ਹੀਦਾਂ ਦਾ ਗੁ ਗੁਰਦੁਆਰਾ ਏ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅੱਛਾ ਜੀ ਠੀਕ ਹੈ ਪੰਜਾਬ ਐਜੁਕੇਸ਼ਨ ਬੋਰਡ ਨਹੀਂ ਨਹੀਂ ਉੱਥੇ ਮੇਰੀ ਨਾ ਮੇਰੀ ਉੱਥੇ ਨਾ ਆਪਣੀ ਉਹ ਡੀ ਐੱਮ ਸੀ ਆਈ ਹੋਈ ਹੈ ਜੀ ਉਹ ਚੱਕਣੀ ਸੀਗੀ ਮੈਂ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 ਠੀਕ ਹੈ ਜੀ ਓਕੇ